ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਸਾਡੀਆਂ ਖੇਡਾਂ ਵਿੱਚ ਜੋ ਕਿ ਪੂਰੇ ਭਾਰਤ ਵਿੱਚ ਚੱਲਦੀਆਂ ਹਨ ਉਹਨਾਂ ਵਿੱਚ ਨਸਲੀ ਸਮੂਹਾਂ ਅਤੇ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਅਤੇ ਇਸ ਇਸ ਦੀ ਨੁਮਾਇੰਦਗੀ ਸਾਨੂੰ ਔਰਤਾਂ ਦੀ ਇਹਨਾਂ ਖੇਡਾਂ ਵਿੱਚ ਹੋਣ ਦੀ ਨੁਮਾਇੰਦਗੀ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਇਹ ਬਹੁਤ ਵਧੀਆ ਗੱਲ ਹੈ ਕਿ ਅਸੀਂ ਸਾਡੇ ਘਰ ਦੀਆਂ ਔਰਤਾਂ ਨੂੰ ਪ੍ਰੇਰਿਤ ਕਰੀਏ ਅਤੇ ਉਹ ਹੋਰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਇਹ ਬਹੁਤ ਵਧੀਆ ਗੱਲ ਹੈ ਇਸਨੂੰ ਬਿਲਕੁਲ ਨਹੀਂ ਬਦਲਣਾ ਚਾਹੀਦਾ ਔਰਤਾਂ ਨੂੰ ਅੱਗੇ ਵੱਧ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਡੇ ਘਰ ਸਾਡੇ ਪਰਿਵਾਰ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ ਅਤੇ ਨਸਲੀ ਸਮੂਹਾਂ ਦਾ ਵੀ ਇਹੀ ਇਹ ਹੈ ਤੁਹਾਨੂੰ ਇਹਨਾਂ ਨੂੰ ਪ੍ਰੇਰਿਤ ਪ੍ਰੇਰਿਤ ਕਰਨਾ ਚਾਹੀਦਾ ਅਤੇ ਇਸਨੂੰ ਬਦਲਣਾ ਨਹੀਂ ਚਾਹੀਦਾ ਅਤੇ ਔਰਤਾਂ ਨੂੰ ਨਵੇਂ ਨਵੇਂ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਸਰੀਰਿਕ ਤੰਦਰੁਸਤੀ ਅਤੇ ਮਾਨਸਿਕ ਤੰਦਰੁਸਤੀ ਨੂੰ ਚੰਗਾ ਰੱਖਣਾ ਚਾਹੀਦਾ ਹੈ ਇਸ ਲਈ ਸਾਨੂੰ ਕਦੀ ਵੀ ਔਰਤਾਂ ਨੂੰ ਇਹਨਾਂ ਖੇਡਾਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਣਾ ਚਾਹੀਦਾ ਕਿਉਂਕਿ ਇਹ ਬਹੁਤ ਵਧੀਆ ਹੈ ਅਤੇ ਇਸ ਨਾਲ ਸਾਡੇ ਦੇਸ਼ ਸਾਡੇ ਦੇਸ਼ ਸਾਡੇ ਘਰ ਦੀਆਂ ਔਰਤਾਂ ਬਹੁਤ ਤਰੱਕੀ ਕਰ ਸਕਦੀਆਂ ਹਨ ਅਤੇ ਇਸ ਇਸ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਗਰਬ ਮਹਿਸੂਸ ਹੋਵੇਗਾ ਸੋ ਇਸ ਲਈ ਖੇਡਾਂ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਵਧੀਆ ਹੈ ਸਾਨੂੰ ਇਸ ਨੂੰ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਮੁੱਦੇ 'ਤੇ ਮੇਰੇ ਵਿਚਾਰ ਇਹੀ ਹਨ ਕਿ ਔਰਤਾਂ ਨੂੰ ਹਰ ਹਰ ਖੇਡ ਵਿੱਚ ਹਿੱਸਾ ਲੈਣਾ ਚਾਹੀਦਾ ਅਤੇ ਦੇਸ਼ ਅਤੇ ਪਰਿਵਾਰ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ ਇਹੀ ਕਹਿਣਾ ਚਾਹੁੰਦਾ ਹਾਂ ਧੰਨਵਾਦ ਸਹਿਤ